ਸਾਡੇ ਖੇਤਰ ਵਿੱਚ ਬਹੁਤ ਸਾਰੇ ਕੁਦਰਤੀ ਸੋਮੇ ਹਨ ਜਿਵੇਂ ਪਾਣੀ ਹੈ ਪਾਣੀ ਤੋਂ ਅਸੀਂ ਬਿਜਲੀ ਉਤਪਾਦ ਕਰ ਸਕਦੇ ਹਾਂ ਅਤੇ ਪਾਣੀ ਨੂੰ ਸਿੰਚਾਈ ਦੇ ਰੂਪ ਵਿੱਚ ਵਰਤ ਕੇ ਖੇਤੀਬਾੜੀ ਦੇ ਵਿੱਚ ਬਹੁਤ ਯੋਗਦਾਨ ਰਹਿੰਦਾ ਉਹਨੂੰ ਵੀ ਅਸੀਂ ਵਪਾਰਕ ਗਤੀਵਿਧੀ ਦੇ ਰੂਪ ਵਜੋਂ ਦੇਖ ਸਕਦੇ ਹਾਂ ਅਤੇ ਸਾਡੇ ਏਰੀਏ ਦੀ ਜਿਹੜੀ ਮਿੱਟੀ ਹੈ ਬਹੁਤ ਉਪਜਾਊ ਆ ਉੱਥੇ ਅਸੀਂ ਵੱਖ ਵੱਖ ਤਰ੍ਹਾਂ ਦੀਆਂ ਫਸਲਾਂ ਉਗਾ ਸਕਦੇ ਹਾਂ ਜਿਹਨੂੰ ਵਪਾਰਕ ਗਤੀਵਿਧੀ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ ਜਿਵੇਂ ਕਣਕ ਝੋਨਾ ਮੱਕੀ ਬਾਜਰਾ ਨਰਮਾ ਸਬਜ਼ੀਆਂ ਅਤੇ ਫਲਾਂ ਦੇ ਬਾਗ ਵੀ ਲਗਾ ਸਕਦੇ ਹਾਂ ਇ ਇਸ ਦੇ ਨਾਲ ਕਿਸਾਨ ਨੇ ਜਿਹੜੇ ਖੇਤੀਬਾੜੀ ਨੂੰ ਇੱਕ ਵਪਾਰਕ ਗਤੀਵਿਧੀ ਵਜੋਂ ਦੇਖਦੇ ਹਨ ਅਤੇ ਇਹਨਾਂ ਕੁਦਰਤੀ ਸੋਮਿਆਂ ਨੂੰ ਇੱਕ ਵਪਾਰਕ ਗਤੀਵਧੀ ਵਿਧੀ ਦੇ ਤੌਰ 'ਤੇ ਵਰਤਦੇ ਹਨ